ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਜਿਆਦਾ ਸ਼ੌਕ ਹੈ ਅਤੇ ਮੇਰੀ ਹੁਣ ਤੱਕ ਦੀ ਸਭ ਤੋਂ ਪਸੰਦੀਦਾ ਕਿਤਾਬ ਹੈ ਰਾਣੀ ਤੱਤ ਜੋ ਕਿ ਹਰਮਨ ਦੁਆਰਾ ਲਿਖੀ ਗਈ ਹੈ ਅਤੇ ਹਰਮਨ ਆਧੁਨਿਕ ਪੰਜਾਬੀ ਦਾ ਇੱਕ ਉੱਭਰਦਾ ਹੋਇਆ ਲਿਖਾਰੀ ਹੈ ਅਤੇ ਉਸਦੀ ਰਾਣੀ ਤੱਤ ਕਿਤਾਬ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਹਨ ਜਿਹਦੇ ਵਿੱਚ ਕੁਦਰਤ ਦੀਆਂ ਗੱਲਾਂ ਕੀਤੀਆਂ ਗਈਆਂ ਹਨ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਗਈਆਂ ਹਨ ਭੈਣ ਭਰਾ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਅਤੇ ਮੈਨੂੰ ਉਸ ਉਸ ਕਿਤਾਬ ਵਿੱਚੋਂ ਦੋ ਤਿੰਨ ਕਵਿਤਾਵਾਂ ਐਦ ਐਦਾਂ ਦੀਆਂ ਹਨ ਜੋ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀਆਂ ਹਨ ਉਹਨਾਂ ਵਿੱਚੋਂ ਹੈ ਕਿਸੇ ਦਾ ਪਿਆਰ ਪਾਵਣ ਲਈ ਭਲਾ ਕੋਈ ਕੀ ਨਹੀਂ ਕਰਦਾ ਉਹ ਪਰਬਤ ਭੋਰ ਦਿੰਦਾ ਹੈ ਉਹ ਪਰਬਤ ਭੋਰ ਦਿੰਦਾ ਹੈ ਉਹ ਰੀਝਾਂ ਹੀ ਨਹੀਂ ਕਰਦਾ ਇਸ ਤੋਂ ਇਲਾਵਾ ਇੱਕ ਭੈਣ ਭਾਈ ਦੇ ਪਿਆਰ ਦੇ ਸੰਬੰਧੀ ਇੱਕ ਕਵਿਤਾ ਹੈ ਅਤੇ ਇੱਕ ਉੱਨੀ ਸੌ ਚੁਰਾਸੀ ਦਾ ਦਾ ਜਿਹੜਾ ਸਾਡੇ 'ਤੇ ਸੰਤਾਪ ਹੰਢਾਇਆ ਅਸੀਂ ਉਸ ਦੇ ਉੱਤੇ ਲਿਖੀ ਗਈ ਹੈ ਉਹ ਕਵਿਤਾਵਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਹਨ